ਹਾਂਜੀ ਮੈਂ ਰੈਸਪੀ ਦੀ ਕਦੇ ਕਦੇ ਵੇਖਦੀ ਹਾਂ ਲੇਕਿਨ ਮੈਂ ਬਿਲਕੁਲ ਰੈਸਪੀ ਦੇ ਅਨੁਸਾਰ ਨਹੀਂ ਬਣਾਉਂਦੀ ਕੁਛ ਆਪਣਾ ਵੀ ਕਰਕੇ ਬਣਾ ਲੈਂਦੀ ਹਾਂ ਅਤੇ ਇੱਕ ਦੋ ਵਾਰੀ ਮੇਰੀ ਦਾਲ ਵਗੈਰਾ ਵਿੱਚ ਸਾਗ ਵਗੈਰਾ 'ਚ ਪ੍ਰੋਬਲਮ ਸੀ ਅਤੇ ਮੈਂ ਆਪਣੀ ਫਰੈਂਡਸ ਨੂੰ ਪੁੱਛਿਆ ਉਹਨੇ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਕਰਕੇ ਬਣਾਓ ਉਸ ਤੋਂ ਬਾਅਦ ਮੈਂ ਸਾਗ ਵਗੈਰਾ ਦਾਲ ਵਗੈਰਾ ਬਣਾਈ ਬੜੀ ਅੱਛੀ ਬਣਦੀ ਸੀ ਔਰ ਮੈਂ ਬਣਾ ਕੇ ਸਭ ਨੂੰ ਖਵਾਈ ਸਭ ਨੂੰ ਬੜੀ ਪਸੰਦ ਆਈ ਬਾਕੀ ਕੀ ਦਾਲ ਹੋ ਗਏ ਬਾਕੀ ਮੈਂ ਡੋਸਾ ਵਗੈਰਾ ਬਣਾ ਲੈਂਦੀ ਹਾਂ ਇੱਕ ਦੋ ਵਾਰੀ ਟਰਾਈ ਕੀਤਾ ਵੈ ਅਤੇ ਹੁਣ ਠੀਕ ਬਣਾ ਲੈਂਦੀ ਹਾਂ ਉਸ ਤੋਂ ਬਾਅਦ ਰੈਸਪੀ ਦੇ ਅਨੁਸਾਰ ਵੀ ਕੁਛ ਕੁਛ ਕਰ ਲਈਦਾ ਯੂਟਿਊਬ 'ਚੋਂ ਵੀ ਦੇਖ ਲਈਦਾ ਵੈ ਔਰ ਡਿਸ਼ ਵਗੈਰਾ ਤਿਆਰ ਕਰਦੇ ਰਹਿੰਦੇ ਹਾਂ ਔਰ ਆਪਣੇ ਫਰੈਂਡਸ ਨੂੰ ਆਪਣੀ ਫੈਮਲੀ ਨੂੰ ਖਵਾਉਂਦੇ ਹਾਂ ਕਈ ਵਾਰ ਬਹੁਤ ਪਸੰਦ ਆਉਂਦਾ ਉਹਨਾਂ ਨੂੰ ਔਰ ਬੜੀ ਪ੍ਰੇਜ਼ ਕਰਦੇ ਆ ਕਿ ਬੜੀ ਅੱਛੀ ਚੀਜ਼ ਬਣੀ ਹੈ ਬਾਕੀ ਸਾਗ ਵਗੈਰਾ ਵੀ ਹੁਣ ਕਾਫ਼ੀ ਅੱਛਾ ਬਣਾਉਣ ਲੱਗ ਗਈ ਹਾਂ ਮੈਂ ਔਰ ਡੋਕਲਾ ਇਡਲੀ ਸਾਂਬਰ ਵਗੈਰਾ ਸਭ ਕੁਛ ਬਣਾ ਲੈਂਦੀ ਹਾਂ ਔਰ ਬਾਕੀ ਟਰਾਈ ਕਰਦੇ ਰਹੋ ਅਤੇ ਸਭ ਕੁਛ ਵਧੀਆ ਬਣ ਹੀ ਜਾਂਦਾ ਬਾਕੀ ਯੂਟਿਊਬ ਵਗੈਰਾ ਤੋਂ ਰੈਸਪੀ ਵਗੈਰਾ ਵੀ ਮੈਂ ਦੇਖ ਲੈਂਦੀ ਹਾਂ ਹੋਰ ਬਾਕੀ ਨਵੀਆਂ ਨਵੀਆਂ ਚੀਜ਼ਾਂ ਟਰਾਈ ਕਰਦੀ ਰਹਿੰਦੀ ਹਾਂ ਰੈਸਪੀ ਵਗੈਰਾ ਵੇਖ ਕੇ ਵੀ ਬਾਕੀ ਥੋੜ੍ਹਾ ਆਪਣਾ ਦਿਮਾਗ ਲਗਾ ਕੇ ਵੀ ਸਭ ਕੁਛ ਮੈਂ ਬਣਾ ਸਕਦੀ ਹਾਂ ਔਰ ਬਣ ਜਾਂਦਾ ਔਰ ਸਭ ਨੂੰ ਬੜਾ ਪਸੰਦ ਆਉਂਦਾ ਹਾਂਜੀ ਅਤੇ ਹੋਰ ਵੀ ਇੱਕ ਦੋ ਚੀਜ਼ਾਂ ਮੈਂ ਆਪਣੀ ਫਰੈਂਡ ਸਰਕਲ 'ਚ ਵੀ ਪੁੱਛੀਆਂ ਉਹਨਾਂ ਨੇ ਵੀ ਮੈਨੂੰ ਦੱਸੀਆਂ ਵੈਂ ਜਿੱਦਾਂ ਡੋਕਲਾ ਵਗੈਰਾ ਹੋ ਗਿਆ ਪੋਹਾ ਵਗੈਰਾ ਹੋ ਗਿਆ ਬੜਾ ਅੱਛਾ ਬਣਦਾ ਏ ਆ ਔਰ ਮੈਂ ਪੁੱਛ ਕੇ ਵੀ ਬਣਾ ਲੈਂਦੀ ਹਾਂ ਅਤੇ ਕਾਫ਼ੀ ਇੰਮਪਰੂਵਮੈਂਟ ਹੁੰਦੀ ਹੈ ਖਾਣੇ ਵਿੱਚ ਔਰ ਰੈਸਪੀ ਵਗੈਰਾ ਤੋਂ ਵੀ ਯੂਟਿਊਬ ਤੋਂ ਵੀ ਤਾਂ ਕਾਫ਼ੀ ਸਾਨੂੰ ਸਹਾਇਤਾ ਮਿਲਦੀ ਆ ਖਾਣਾ ਬਣਾਉਣ 'ਚ